ਪੰਜਾਬੀ ਗਾਣੇ ਪੰਜਾਬ ਚ ਹੀ ਨਹੀਂ ਸਗੋਂ ਸਾਰੇ ਹੀ ਦੁਨੀਆਂ ਵਿੱਚ ਬਹੁਤ ਹੀ ਪਸੰਦ ਕੀਤੇ ਜਾਂਦੇ ਨੇ ਤੇ ਪੰਜਾਬੀ ਗਾਣਿਆਂ ਦੀ ਜੇ ਮੈਂ ਗੱਲ ਕਰਾਂ ਤਾਂ ਸ਼ੁਰੂ ਤੋਂ ਹੀ ਅਸੀਂ ਜਿਵੇਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਬਹੁਤ ਬਚਪਨ ਚ ਵੀ ਅਸੀਂ ਸ਼ੁਰੂ ਤੋਂ ਹੀ ਭੰਗੜਾ ਪਾਉਂਦੇ ਆ ਰਹੇ ਹਾਂ ਇਹਨਾਂ ਤੇ ਤੇ ਪਹਿਲਾਂ ਗੁਰਦਾਸ ਮਾਨ ਜੀ ਦੇ ਗਾਣੇ ਬਹੁਤ ਸੁਣਦੇ ਸੀ ਤੇ ਨੈਚੁਰਲੀ ਉਤੇ ਭੰਗੜਾ ਬਹੁਤ ਸੋਹਣਾ ਪੈਂਦਾ ਹੈ ਫੇਰ ਮਲਕੀਤ ਸਿੰਘ ਜੀ ਦੇ ਗਾਣੇ ਉਹਨਾਂ ਤੇ ਜਿਵੇਂ ਗੁਡ ਨਾਲੋਂ ਇਸ਼ਕ ਮਿੱਠਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਪੰਜਾਬੀ ਗਾਣਿਆਂ ਚ ਵੀ ਬਹੁਤ ਸਾਰੀਆਂ ਤਬਦੀਲੀਆਂ ਦੇਖ ਰਹੇ ਹਾਂ ਅਸੀਂ ਤੇ ਅੱਜ ਕੱਲ ਦੀ ਜੇ ਮੈਂ ਗੱਲ ਕਰਾਂ ਤਾਂ ਦਿਲਜੀਤ ਦੇ ਗਾਣੇ ਕਿਉਂਕਿ ਦਿਲਜੀਤ ਆਪਣੇ ਪੂਰਾ ਪੰਜਾਬੀ ਦੂਰ ਤੇ ਸੀ ਤੇ ਜਿਵੇਂ ਹੁਣੇ ਸਾਰੀ ਦੁਨੀਆਂ ਚ ਮਸ਼ੂਰ ਕੀਤਾ ਪੰਜਾਬੀ ਆ ਗਏ ਓਏ ਤੇ ਉਹਦੇ ਗਾਣੇ ਤੇ ਜਿਵੇਂ ਹੁਣ ਥੋੜੇ ਜਿਹੇ ਨਾਮ ਲਾਉਗੇ ਉਹੀ ਗਾਣਿਆਂ ਦੇ ਜ਼ਿਆਦਾ ਜਿਵੇਂ ਕਿ ਫਲਾਈ ਕਰਦਾ ਕੇਸ ਚੱਲਦਾ ਟੈਨਸ਼ਨ ਮਿੱਤਰਾਂ ਨੂੰ ਹੈ ਨੀ ਤੇ ਮੈਂ ਤੇਰਾ ਲਵਰ ਇਹਨਾਂ ਤੇ ਅਸੀਂ ਭੰਗੜੇ ਪਾਣੇ ਅੱਜਕੱਲ ਡੈਫਨੇਟਲੀ ਪਸੰਦ ਕਰਦੇ ਆ ਤੇ ਹੋਰ ਵੀ ਬਹੁਤ ਸਾਰੇ ਅੱਜਕੱਲ ਜਿਵੇਂ ਬੱਚੇ ਸੁਣਦੇ ਆ ਅਸੀਂ ਸੁਣਦੇ ਆਂ ਏ ਪੀ ਢਿੱਲੋ ਦੇ ਗਾਣੇ ਬਰਾਉਨ ਮੁੰਡੇ ਤੇ ਫਿਰ ਵਿੱਚ ਬਾਦਸ਼ਾਹ ਦੇ ਵੀ ਗਾਣੇ ਆ ਤੇ ਨਵੀ ਦੇ ਵੀ ਗਾਣੇ ਜਿਵੇਂ ਵੱਖਰਾ ਸਵੈਗ ਹੈ ਤੇ ਇਥੇ ਅਸੀਂ ਪੰਜਾਬੀ ਭੰਗੜੇ ਪਾਣੇ ਬਹੁਤ ਪਸੰਦ ਕਰਦੇ ਹਾਂ ਤੇ ਬਾਕੀ ਜਿਹੜੇ ਹੈਗੇ ਆ ਹੋਰ ਭੰਗੜਾ ਤਾਂ ਸਾਡੀ ਪੰਜਾਬੀਆਂ ਦੇ ਖੂਨ ਚ ਹੀ ਹੁੰਦਾ ਹੈ ਤੇ ਅਸੀਂ ਭਾਵੇਂ ਉਹ ਪੰਜਾਬੀ ਵੀਟ ਹੋਵੇ ਭਾਵੇਂ ਨਾ ਹੋਵੇ ਹਰੇਕ ਅਸੀਂ ਗਾਣੇ ਤੇ ਭੰਗੜਾ ਪਾ ਹੀ ਲੈਂਦੇ ਹਾਂ ਪੰਜਾਬੀ ਕਿਉਂਕਿ ਅਸੀਂ ਪੰਜਾਬੀ ਹੁੰਦੇ ਆਂ